ਹਾਂ ਮੈਂ ਸ਼ੇਅਰ ਮਾਰਕੀਟ ਬਾਰੇ ਜਾਣਦੀ ਹਾਂ ਸ਼ੇਅਰ ਮਾਰਕੀਟ ਵਿੱਚ ਜਿਹੜੇ ਲੋਕ ਹੁੰਦੇ ਹਨ ਉਹ ਕੰਪਨੀ ਦੇ ਸ਼ੇਅਰ ਖਰੀਦਦੇ ਹਨ ਉਹ ਪੈਸੇ ਦਿੰਦੇ ਹਨ ਅਤੇ ਸ਼ੇਅਰ ਖਰੀਦ ਲੈਂਦੇ ਹਨ ਅਤੇ ਉਨ੍ਹਾਂ ਨੂੰ ਕੰਪਨੀ ਦੀ ਮਲਕੀਅਤ ਪ੍ਰਾਪਤ ਹੋ ਜਾਂਦੀ ਹੈ ਜਿੰਨੇ ਦੇ ਉਹਨਾਂ ਨੇ ਸ਼ੇਅਰ ਖਰੀਦੇ ਹੁੰਦੇ ਹਨ ਅਤੇ ਉਹ ਸ਼ੇਅਰ ਮਾਰਕੀਟ ਜਿਹੜੀ ਹੁੰਦੀ ਆ ਉਹਦੇ ਰੇਟ ਬੜੀ ਜਲਦੀ ਵੱਧਦੇ ਵੀ ਹਨ ਅਤੇ ਘੱਟਦੇ ਵੀ ਹਨ ਅਤੇ ਇਹ ਸਾਡੇ ਲਈ ਖਤਰਨਾਕ ਵੀ ਸਾਬਤ ਹੋ ਸਕਦੇ ਹਨ ਅਤੇ ਫਾਇਦੇਮੰਦ ਵੀ ਸ਼ੇਅਰ ਮਾਰਕੀਟ ਇੱਕ ਹਿਸਾਬ ਦੀ ਸੱਟੇਬਾਜ਼ੀ ਟਾਈਪ ਹੁੰਦੀ ਹੈ ਜਿਹਨੂੰ ਮਤਲਬ ਕਿ ਜੇ ਤਾਂ ਤੁਹਾਡਾ ਮਤਲਬ ਕਿ ਕਮ ਜਿਹੜੇ ਤੁਸੀਂ ਸ਼ੇਅਰ 'ਚ ਪੈਸੇ ਲਗਾਏ ਜੇ ਉਹਦਾ ਰੇਟ ਵੱਧ ਗਿਆ ਤਾਂ ਫਿਰ ਤਾਂ ਤੁਹਾਨੂੰ ਬੈਨ ਬੈਨੀਫਿਟ ਹੋ ਜਾਵੇਗਾ ਪਰ ਜੇ ਉਹਦਾ ਰੇਟ ਘੱਟ ਗਿਆ ਫਿਰ ਤੁਹਾਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਜਾਵੇਗਾ ਇਹਦਾ ਕੋਈ ਭਰੋਸਾ ਨਹੀਂ ਹੈਗਾ ਇਹ ਤੁਹਾਨੂੰ ਅਰਸ਼ ਤੋਂ ਫਰਸ਼ 'ਤੇ ਪਹੁੰਚਾ ਦੇਵੇਗੀ ਸ਼ੇਅਰ ਮਾਰਕੀਟ ਹਾਂ ਇਹਦੇ ਵਿੱਚ ਕੁਝ ਅੱਜ ਕੱਲ੍ਹ ਡਿਜੀਟਲ ਐਪਸ ਵੀ ਆ ਗਏ ਹਨ ਸ਼ੇਅਰ ਮਾਰਕੀਟ ਕਰਨ ਦੇ ਲਈ ਜਿਹਦੇ ਵਿੱਚ ਘਰ ਬੈਠੇ ਹੀ ਜਿਹੜੇ ਸ਼ੇਅਰ ਹੋਲਡਰ ਹੁੰਦੇ ਆ ਉਹਨੂੰ ਕੰਪਨੀ ਨੂੰ ਚੰਗੇ ਤਰੀਕੇ ਨਾਲ ਵੇਖ ਸਕਦੇ ਹਨ ਕਿ ਕੰਪਨੀ ਵਿੱਚ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਕੰਪਨੀ ਨੂੰ ਫਾਇਦਾ ਹੋ ਰਿਹਾ ਜਾਂ ਨੁਕਸਾਨ ਹੋ ਰਿਹਾ ਅਸੀਂ ਸਾਨੂੰ ਇਹਦੇ ਤੋਂ ਪੈਸੇ ਲਗਾਉਣੇ ਚਾਹੀਦੇ ਹਨ ਜਾਂ ਨਹੀਂ ਲਗਾਉਣੇ ਚਾਹੀਦੇ ਜਾਂ ਰੱਖੇ ਰੱਖੀਏ ਜਾਂ ਕੱਢ ਲਈਏ ਸਾਰੀ ਜਿੰਨੀ ਵੀ ਹੁੰਦੀ ਹੈ ਇਨਫੋਰਮੇਸ਼ਨ ਉਹ ਸਾਰੀ ਉੱਤੇ ਦਿੱਤੀ ਹੁੰਦੀ ਹੈ ਡਿਜੀਟਲ ਐਪ 'ਤੇ ਅੱਜ ਕੱਲ੍ਹ ਜਿਹੜੀਆਂ ਦਿੱਤੀਆਂ ਹੋਈਆਂ ਹਨ ਅਤੇ ਭਾਵੇਂ ਉਹ ਜਿੱਥੇ ਮਰਜ਼ੀ ਬੈਠੇ ਹੋਣ ਸ਼ੇਅਰ ਹੋਲਡਰ ਉਹਨਾਂ ਨੂੰ ਕੰਪਨੀ ਦੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਐਪ ਦੇ ਥਰੂ ਮਿਲ ਹੀ ਜਾਵੇਗੀ ਅਤੇ ਇਹਦਾ ਇਹ ਬੈਨੀਫਿਟ ਹੈਗਾ ਵੈ ਕਿ ਸਾਨੂੰ ਇਹਨਾਂ ਨੂੰ ਸ਼ੇਅਰ ਹੋਲਡਰਜ਼ ਨੂੰ ਇੱਕ ਸੇਫਟੀ ਮਿਲ ਗਈ ਹੋਈ ਆ ਜਿਹੜੀ ਪਹਿਲਾਂ ਨਹੀਂ ਸੀ ਮਿਲੀ ਹੋਈ